ਸਾਨੂੰ ਆਰਥਿਕਤਾ ਲੋਕਲ ਇਕਨੋਮਿਕ ਵਿੱਚ ਛੋਟੇ ਅਤੇ ਵਿਚਕਾਰਲੇ ਦਰਮਿਆਨੇ ਕਾਰ ਦੇ ਕਾਰੋਬਾਰ ਬਹੁਤ ਅੱਛੀ ਭੂਮਿਕਾ ਨਿਭਾਉਂਦੇ ਹਨ ਜਿਵੇਂ ਕਿ ਫੋਰਮਿੰਗ ਫੋਰਮਿੰਗ ਦੇ ਵਿੱਚ ਖੇਤੀਬਾੜੀ ਕਰਦੇ ਨੇ ਲੋਕ ਕਿਸਾਨ ਜਿਹੜੇ ਖੇਤੀਬਾੜੀ ਕਰਦੇ ਨੇ ਉਹ ਆਪਣਾ ਜਿੰਨਾ ਪੈਸਾ ਖਰਚ ਕਰਦੇ ਨੇ ਠੀਕ ਹੈ ਉਦੂ ਬਾਅਦ 'ਚੋਂ ਛੋਟੇ ਤੋਂ ਛੋਟਾ ਬਿਜਨਸ ਕਰਦੇ ਨੇ ਉਹ ਖੇਤੀਬਾੜੀ ਦਾ ਜਾਂ ਫਿਰ ਵੱਡੇ ਤੋਂ ਵੱਡਾ ਜਿਵੇਂ ਵੱਡਾ ਕਿਸਾਨ ਹੈ ਉਹ ਵੀ ਖਰਚ ਕਰਕੇ ਖੇਤੀ ਤੋਂ ਅੱਛੀ ਜਿਹੜੀ ਆਪਣਾ ਇਕਨੋਮਿਕ ਹੈ ਅੱਛੀ ਆਰਥਿਕਤਾ ਉਹ ਅੱਛੀ ਕਰਦਾ ਉਹ ਪੂਰੀ ਕਰਦਾ ਉਸਦੇ ਮੁਤਾਬਿਕ ਜਿਹੜੀ ਜੀਡੀਪੀ ਆ ਉਹ ਵੀ ਇਨਕ੍ਰੀਜ ਹੁੰਦੀ ਹੈ